ਲੋਕਾਂ ਦੇ ਨਾਮ ਇਸ ਤਰ੍ਹਾਂ ਹਨ ਜੈਕੋਬ ਮੇਚਲ ਮਨਿੰਦਰ ਮਨਜੋਤ ਮਨਰਾਜ ਮੈਥਿਊ ਵਿਰਾਟ ਕੋਹਲੀ ਕ੍ਰਿਸਟੋਫਰ ਦੈਨੀਅਲ ਮਨਵੀਰ ਜੋਸਫ ਵਿਲੀਅਮ ਐਥਨੀ ਡੇਵਿਡ ਲੈਗਜੈਂਡਰ ਨਿਕਲਸ ਰਿਆਨ ਜੇਮਸ ਜੋਨ ਰਾਮ ਜਸਪ੍ਰੀਤ ਬ੍ਰਾਂਡਨ ਕ੍ਰਿਸਚੀਅਨ ਸੈਮਿਲ ਨੇਥਨ ਲੋਗਨ ਜਸਟਿਨ ਗਬਰਲ ਜੋਸ ਕੈਵਿਨ ਅਲੀਜ਼ਾ ਥੋਮਸ ਜੋਰਡਨ ਕੈਮਰੋਨ ਜੈਕਸਨ ਈਵਾਨ ਇਸਾਕ ਮੇਸ਼ਨ ਜੇਸਨ ਐਰਨ ਫਿੰਚ ਕਾਈਲੇ ਚਾਰਲਸ ਐਡਮ ਲੁਕਾਸ ਬਰਿਆਨ ਨੈਥੀਨਲ ਕਾਰਲਸ ਓਵੇਨ ਜੀਸਸ ਲੈਂਡਨ ਕੋਲ ਐਗਜੇਵੀਅਰ ਬਰੇਡਨ ਹੇਡਨ ਨਹਿਰਾ ਅਗਰਕਰ ਰਿਚਰਡ ਵਿਲੀਅਮਸਨ ਲੀਅਮ

ਲੈਜੰਡਰੋ ਹੈਨਰੀ ਵਿਕਟਰ ਜੇਕ ਰਾਲੀ ਮਾਕ ਮਾਰਕਸ ਕੇਡਨ ਕਨੇਥ ਜੋਇਲ ਟੋਲ ਐਡਵਰਡ ਮੈਕਸਵੈਲ ਸਟੀਫਨ ਨਿਕਲਸ ਜੋਰਜ ਰਿ ਰਿਕਾਰਡੋ ਕ੍ਰਿਸਚਨ